ਤੁਹਾਡੇ ਅਨੁਸਾਰ ਭੰਗੜਾ ਐਰੋਬਿਕਸ ਬਾਰੇ ਲੋਕਾਂ ਦੀਆਂ ਸਭ ਤੋਂ ਵੱਡੀਆਂ ਗਲਤ ਧਾਰਨਵਾਂ ਕੀ ਹਨ ਅਤੇ ਤੁਸੀਂ ਉਹਨਾਂ ਨੂੰ ਕਿਵੇਂ ਹੱਲ ਕਰੋਗੇ ਸਾਡੇ ਮੁਤਾਬਿਕ ਲੋਕ ਤਾਂ ਇੱਦਾਂ ਦੇ ਹੁੰਦੇ ਹਨ ਜਿਵੇਂ ਕਿ ਕਹਾਵਤ ਬਣੀ ਹੈ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹਾਂ ਪਾਸੇ ਦੰਦੇ ਜੇ ਕੋਈ ਭੰਗੜਾ ਨਹੀਂ ਪਾਉਂਦਾ ਤਾਂ ਲੋਕ ਕਹਿੰਦੇ ਆ ਇਹ ਕਿਸੇ ਕੰਮ ਦਾ ਨਹੀਂ ਇਹਨੂੰ ਤਾਂ ਫੰਕਸ਼ਨ 'ਤੇ ਲੈ ਜਾਓ ਅਤੇ ਇਹਨੂੰ ਤਾਂ ਭੰਗੜਾ ਨਹੀਂ ਪਾਉਣਾ ਆਉਂਦਾ ਬੈਠਾ ਰਹਿੰਦਾ ਮੂੰਹ ਬਣਾ ਕੇ ਅਤੇ ਜੇ ਕੋਈ ਖੁੱਲ੍ਹ ਕੇ ਭੰਗੜਾ ਪਾ ਲੈਂਦਾ ਤਾਂ ਕਹਿੰਦੇ ਨੇ ਇਹਨੇ ਤਾਂ ਸ਼ਰਮ ਹੀ ਲਾਈ ਹੋਈ ਹੈ ਕੰਜਰਾ ਵਾਂਗੂ ਨੱਚ ਰਿਹਾ ਇਸ ਲਈ ਦੁਨੀਆਂ ਦਾ ਕੀ ਹੈ ਦੁਨੀਆਂ ਤਾਂ ਇਹ ਕੁਛ ਕਹਿੰਦੀ ਹੈ ਬੰਦੇ ਨੂੰ ਕਿਸੇ ਪਾਸੇ ਵੀ ਜਿਊਣ ਨਹੀਂ ਦਿੰਦੀ ਜੇ ਬੱਚੇ ਭੰਗੜਾ ਪਾਉਂਦੇ ਆ ਉਹਨਾਂ ਦੇ ਮਾਪੇ ਉਹਨੂੰ ਕਹਿੰਦੇ ਆ ਤੂੰ ਸੱਟ ਲਵਾ ਲਏਗਾ ਜਾ ਕੇ ਆਪਣੀ ਪੜ੍ਹਾਈ ਕਰ ਪੜ੍ਹਾਈ ਕੰਮ ਆਉਣੀ ਭੰਗੜਾ ਕੋਈ ਕੰਮ ਨਹੀਂ ਆਉਣਾ ਪਰ ਅੱਜਕੱਲ੍ਹ ਤਾਂ ਜਿਹੜਾ ਇੱਕ ਭੰਗੜਾ ਵੀ ਆ ਉਹ ਵੀ ਬਿਜਨਸ ਦਾ ਸਾਧਨ ਬਣ ਗਿਆ ਵਾ ਕਲਾਸਾਂ ਲੱਗਦੀਆਂ ਨੇ ਫਿਲਮਾਂ 'ਚ ਕੰਮ ਮਿਲ ਜਾਂਦਾ ਹੋਰ ਕਈ ਕੰਮ ਹੈ ਨਾਲੇ ਉਹਨਾ ਸ਼ਾਂਤੀ ਮਿਲਦੀ ਪਰ ਲੋਕ ਇਹ ਗੱਲ ਸਮਝਦੇ ਨਹੀਂ ਹੈਗੇ